ਜੇਕਰ ਅਸੀਂ ਸਾਫ ਸਫਾਈ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਅਸੀਂ ਆਪਣਾ ਜਿਹੜੇ ਘਰ ਦਾ ਕੂੜਾ ਉਹ ਟਾਈਮ ਸਿਰ ਚੁਕਾਂਦੇ ਹਾਂ ਉਹਦੇ ਲਈ ਅਸੀਂ ਸਾਫ ਸਫਾਈ ਵਾਲੇ ਕਰਮਚਾਰੀ ਨਿਯੁਕਤ ਕੀਤੇ ਹਨ ਜਿਹੜਾ ਕਿ ਦੂਜੇ ਤੀਜੇ ਦਿਨ ਹੀ ਸਾਰਾ ਕੂੜਾ ਲੈ ਕੇ ਜਾਂਦੇ ਹਨ ਗਿਲਾ ਤੇ ਸੁੱਕਾ ਦੋਵੇਂ ਤਰ੍ਹਾਂ ਦਾ ਕੂੜਾ ਉਹ ਵੱਖਰਾ ਵੱਖਰਾ ਕਰਦੇ ਹਨ ਇਹਦੇ ਕਰਕੇ ਅਸੀਂ ਕਈ ਬਿਮਾਰੀਆਂ ਤੋਂ ਬਚਦੇ ਹਾਂ ਇਹਨਾਂ ਦੇ ਕੂੜੇ ਕਰਕੇ ਹੀ ਕਈ ਮੱਖੀਆਂ ਮੱਛਰ ਤੁਹਾਡੇ ਆਲੇ ਦੁਆਲੇ ਰਹਿੰਦੇ ਹਨ ਅਤੇ ਉਹ ਨਾ ਚੁਕਾਇਆ ਜਾਵੇ ਤੇ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ ਫੇਰ ਦੂਸਰੀ ਗੱਲ ਅਸੀਂ ਸਾਡੇ ਇਲਾਕੇ ਚ ਜਿਹੜਾ ਪਾਰਕ ਹ ਅਸੀਂ ਉਥੇ ਅੱਛਾ ਮਾਲੀ ਮੁਹਾਇਆ ਕਰਾਇਆ ਹੈ ਜਿਹੜਾ ਕਿ ਪਾਰਕ ਦੀ ਸਾਰੀ ਸਾਫ ਸਫਾਈ ਰੱਖਦਾ ਹੈ ਹਰਿਆਲੀ ਰੱਖਦਾ ਹੈ ਜਿਹਦੇ ਕਰਕੇ ਕਿ ਅਸੀਂ ਪਾਰਕਾਂ ਚ ਜਾ ਕੇ ਅੱਛਾ ਫੀਲ ਕਰਦੇ ਹਾਂ ਫਿਰ ਅਸੀਂ ਆਪਣੇ ਘਰਾਂ ਦੇ ਬਾਹਰ ਛੋਕਾ ਟਰੀ ਲਗਾਏ ਹਨ ਜਿਹੜੇ ਕਿ ਜਗ੍ਹਾ ਵੀ ਘੱਟ ਘੇਰਦੇ ਹਨ ਅਤੇ ਸਿੱਧਾ ਹੀ ਉੱਪਰ ਹੁੰਦੇ ਹਨ ਉਹਨਾਂ ਕਰਕੇ ਵੀ ਅਸੀਂ ਵਾਤਾਵਰਨ ਚ ਸ਼ੁੱਧ ਹਵਾ ਲੈਂਦੇ ਹਾਂ